ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਬੋਲ ਰਹੀ ਹਾਂ ਕੀ ਤੁਸੀਂ ਰਮਨ ਟਰੈਵਲਰਜ਼ ਤੋਂ ਗੱਲ ਕਰ ਰਹੇ ਹੋ ਸਰ ਅਸੀਂ ਇੱਕ ਕੈਬ ਬੁੱਕ ਕਰਵਾਉਣੀ ਸੀ ਫਤਿਹਗੜ੍ਹ ਸਾਹਿਬ ਤੱਕ ਜਾਣ ਲਈ ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਨੇ ਅਸੀਂ ਚਾਰ ਮੈਂਬਰ ਆ ਤੁਸੀਂ ਸਾਨੂੰ ਦੱਸ ਦਿਓ ਕਿ ਚਾਰ ਜਾਣਿਆਂ ਲਈ ਕਿਹੜੀ ਗੱਡੀ ਠੀਕ ਰਹੇਗੀ ਅਤੇ ਉਹਦੀ ਕੀਮਤ ਵੀ ਸਾਨੂੰ ਨਾਲ ਦੱਸ ਦਿਓ ਇਹ ਵੀ ਹੋ ਸਕਦਾ ਵੀ ਸਾਡੇ ਵਿੱਚ ਇੱਕ ਜਾਂ ਦੋ ਮੈਂਬਰ ਦਾ ਵਾਧਾ ਹੋ ਜੇ ਮਨ ਲਉ ਅਗਰ ਅਸੀਂ ਛੇ ਜਾਣੇ ਹੋ ਜਾਂਦੇ ਹਾਂ ਤਾਂ ਤੁਸੀਂ ਸਾਨੂੰ ਇਹ ਵੀ ਦੱਸ ਦਿਓ ਵੀ ਛੇ ਜਾਣਿਆਂ ਲਈ ਕਿਹੜੀ ਗੱਡੀ ਠੀਕ ਬੈਠੇਗੀ ਅਤੇ ਉਸ ਦੀ ਜਾਂ ਰੇਟ ਕੀਮਤ ਕੀ ਹੋਵੇਗੀ ਇਹ ਮੇਰਾ ਜਿਸ ਨੰਬਰ ਤੋਂ ਮੈਂ ਗੱਲ ਕਰ ਰਹੀ ਹਾਂ ਇਹਦੇ 'ਤੇ ਵਟਸਐਪ ਵੀ ਚਲਦਾ ਇਹ ਸਮੁੱਚੀ ਜਾਣਕਾਰੀ ਤੁਸੀਂ ਮੈਨੂੰ ਇਸ ਨੰਬਰ 'ਤੇ ਵੀ ਦੇ ਸਕਦੇ ਹੋ ਅਤੇ ਕਾਲ ਵੀ ਸਕਦੇ ਹੋ ਧੰਨਵਾਦ ਜੀ